ਅੱਜ ਕੱਲ੍ਹ ਸਕੂਲਾਂ ਵਿੱਚ ਬੱਚਿਆਂ ਨੂੰ ਇੰਗਲਿਸ਼ ਪੰਜਾਬੀ ਹਿੰਦੀ ਸਮਾਜਿਕ ਸਿੱਖਿਆ ਵਿਗਿਆਨ ਖੇਡਾਂ ਨਾਲ਼ ਜੁੜੀ ਪ੍ਰੀਖਿਆ ਪੜ੍ਹਾਈ ਜਾਂਦੀ ਹੈ ਅਧਿਆਪਕ ਅੱਜ ਕੱਲ੍ਹ ਸਕੂਲਾਂ ਵਿੱਚ ਚੰਗੇ ਅਤੇ ਪੜ੍ਹੇ ਲਿਖੇ ਹਨ ਜੋ ਕਿ ਬੱਚਿਆਂ ਨੂੰ ਇੱਕ ਵਧੀਆ ਅਤੇ ਸਹੀ ਮਾਰਗ ਦਿਖਾਉਂਦੇ ਹਨ ਜਿਹੜਾ ਕਿ ਉਹਨਾਂ ਦੇ ਆਉਣ ਵਾਲ਼ੀ ਜਿੰਦਗੀ ਵਿੱਚ ਉਹਨਾਂ ਦੇ ਕੰਮ ਆਉਂਦਾ ਹੈ